ਮੈਨੂੰ ਕਲਾ ਬਣਾਉਣ ਲਈ ਸਭ ਤੋਂ ਜ਼ਿਆਦਾ ਪ੍ਰਭਾਵਿਤ ਸਾਡੇ ਮਾਸਟਰ ਜੀ ਨੇ ਕੀਤਾ ਹੈ ਸਾਡੇ ਡਰਾਇੰਗ ਦੇ ਮਾਸਟਰ ਜੀ ਬਹੁਤ ਹੀ ਜ਼ਿਆਦਾ ਕਲਾ ਵਿੱਚ ਨਿਪੁੰਨ ਸਨ ਅਤੇ ਉਹ ਹਰ ਤਰ੍ਹਾਂ ਦੀ ਚਿੱਤਰਕਾਰੀ ਬਹੁਤ ਹੀ ਜ਼ਿਆਦਾ ਪਿਆਰ ਅਤੇ ਵਧੀਆ ਤਰੀਕੇ ਨਾਲ ਕਰਦੇ ਸਨ ਉਨ੍ਹਾਂ ਨੂੰ ਦੇਖ ਕੇ ਸਾਨੂੰ ਸਾਨੂੰ ਵੀ ਇਦਾਂ ਹੁੰਦਾ ਸੀ ਕਿ ਅਸੀਂ ਉਨ੍ਹਾਂ ਵਰਗੇ ਚਿੱਤਰ ਬਣਾਈਏ ਅਤੇ ਇਸਨੂੰ ਦੇਖ ਕੇ ਹੀ ਅਸੀਂ ਉ ਉਨ੍ਹਾਂ ਦੇ ਨਾਲ ਨਾਲ ਚਿੱਤਰ ਬਣਾਉ ਬਣਾਉਂਦੇ ਗਏ ਅਤੇ ਇਸ ਕਲਾ ਵਿੱਚ ਨਿਪੁੰਨ ਹੁੰਦੇ ਗਏ ਜਿਸ ਕਾਰਨ ਅੱਜ ਇਹ ਸਾਡੀ ਹੌਬੀ ਬਣ ਚੁੱਕੀ ਹੈ ਨਾਲ ਹੀ ਨਾਲ ਇਸ ਨੂੰ ਮੈਂ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗਾ ਅਤੇ ਆਪਣੇ ਮਾਸਟਰ ਜੀ ਜਿੰਨਾ ਨਿਪੁੰਨ ਬਣ ਬ ਬਣਨਾ ਚਾਹੁੰਗਾ